ਸਾਡੇ ਸਥਾਨ ਫਾਜ਼ਿਲਕਾ ਵਿੱਚ ਸਥਾਨਕ ਕਲਾਵਾਂ ਦੇ ਤੌਰ 'ਤੇ ਜੋਤੀ ਇੱਕ ਬਹੁਤ ਹੀ ਵਧੀਆ ਤੌਰ ਦੀ ਕਾਰੋਬਾਰ ਹੈ ਜਿਸ ਵਿੱਚ ਸਰਕਾਰ ਦੁਆਰਾ ਬਹੁਤ ਹੀ ਸਹਾਇਤਾ ਕੀਤੀ ਜਾਂਦੀ ਹੈ ਇਹ ਇਕ ਸਮਾਲ ਸਕੇਲ ਇੰਡਸਟਰੀ ਹੈ ਸਮਾਲ ਸਕੇਲ ਇੰਡਸਟਰੀ ਦੇ ਤੌਰ 'ਤੇ ਸਰਕਾਰ ਵੱਲੋਂ ਕਰਜ਼ਾ ਵੀ ਦਿੱਤਾ ਜਾਂਦਾ ਹੈ ਅਤੇ ਉਸ ਕਰਜ਼ੇ ਉੱਪਰ ਬਹੁਤ ਹੀ ਸਬਸਿਡੀ ਵੀ ਪ੍ਰਦਾਨ ਕੀਤੀ ਜਾਂਦੀ ਹੈ ਇਹ ਲੋਨ ਬਹੁਤ ਹੀ ਘੱਟ ਰੇਟ ਆਫ ਇੰਟਰਸਟ 'ਤੇ ਪ੍ਰਦਾਨ ਕੀਤਾ ਜਾਂਦਾ ਹੈ ਜਿਸ ਵਿੱਚ ਲੋਨ ਲੈਣ ਵਾਲੇ ਨੂੰ ਬਹੁਤ ਹੀ ਫਾਇਦਾ ਹੁੰਦਾ ਹੈ ਇਹ ਰੁਜ਼ਗਾਰ ਵੱਲੋਂ ਵੀ ਇੱਕ ਵਧੀਆ ਤਰੀਕਾ ਵਧੀਆ ਪੱਖ ਰੁਜ਼ਗਾਰ ਵੱਲੋਂ ਵੀ ਇੱਕ ਵਧੀਆ ਤਰੀਕਾ ਜਿਸ ਵਿੱਚ ਲੋਕ ਇਸ ਨਾਲ ਰੁਜ਼ਗਾਰ ਵੀ ਵਧਦਾ ਹੈ ਅਤੇ ਬਣਾਉਣ ਵਿੱਚ ਬਹੁਤ ਹੀ ਘੱਟ ਜਗ੍ਹਾ ਦਾ ਇਸਤੇਮਾਲ ਹੁੰਦਾ ਹੈ ਇਹ ਬਹੁਤ ਹੀ ਸੁੰਦਰ ਸੁੰਦਰ ਡਿਜ਼ਾਇਨ ਵਿੱਚ ਬਣਾਈ ਜਾਂਦੀ ਹੈ ਅਤੇ ਲੋਕਾਂ ਨੂੰ ਬਹੁਤ ਲੋਕਾਂ ਦੁਆਰਾ ਬਹੁਤ ਹੀ ਪਸੰਦ ਕੀਤੀ ਜਾਂਦੀ ਹੈ ਅਤੇ ਇਸ ਨੂੰ ਆਪਾਂ ਅੱਗੇ ਵੀ ਵਧਾ ਸਕਦੇ ਹਾਂ ਪੂਰੇ ਪੰਜਾਬ ਲੈਵਲ 'ਤੇ ਅਤੇ ਪੂਰੇ ਦੇਸ਼ ਦੇ ਨੈਸ਼ਨਲ ਲੈਵਲ 'ਤੇ ਆਪਾਂ ਇਸ ਨੂੰ ਵਧਾ ਸਕਦੇ ਹਾਂ ਇਹ ਬਹੁਤ ਹੀ ਵਧੀਆ ਕਾਰੋਬਾਰ ਹੈ ਅਤੇ ਸਰਕਾਰ ਵੱਲੋਂ ਇਸ ਨੂੰ ਫੰਡਿੰਗ ਵੀ ਕੀਤੀ ਜਾਂਦੀ ਹੈ ਧੰਨਵਾਦ